ਹਾਂਜੀ ਸਾਡੇ ਖੇਤ ਰੋਪੜ ਜ਼ਿਲ੍ਹੇ ਵਿੱਚ ਜਾਂ ਖੇਤਰ ਵਿੱਚ ਸੈਲਾਨੀ ਆਕਰਸ਼ਨ ਹਨ ਜੋ ਸਾਡੀ ਭਾਈਚਾਰਕ ਸਾਂਝ ਨੂੰ ਵਧਾਉਂਦੇ ਹਨ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਬਾਗ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਬੈਠ ਕੇ ਸਲਾਹ ਮਸ਼ਵਰਾ ਕੀਤਾ ਸੀ ਇੱਥੇ ਇੱਥੇ ਆ ਕੇ ਲੋਕ ਸ਼ਾਂਤਮਈ ਢੰਗ ਨਾਲ ਆਪਣੇ ਮਸਲੇ ਸੁਲਝਾਉਂਦੇ ਹਨ ਅਤੇ ਜੇ ਜੇ ਕਿਸੇ ਨੇ ਰੋਕਾ ਜਾਂ ਆਪਣੀ ਲੜਾਈ ਨੂੰ ਸੁਲਝਾਉਣਾ ਹੋਵੇ ਤਾਂ ਉਹ ਇੱਥੇ ਆ ਕੇ ਆਪਣੇ ਮਸਲੇ ਸੁਲਝਾ ਸਕਦੇ ਹਨ ਇੱਥੇ ਆ ਕੇ ਲੋਕ ਸੈਰ ਸਪਾਟੇ ਅਤੇ ਗੀਤ ਵੀ ਗਾਉਂਦੇ ਹਨ ਸੈਰ ਸਪਾਟਾ ਕਰਦੇ ਸਮੇਂ ਲੋਕ ਆਪਣੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਂਦੇ ਹਨ ਇਸ ਤੋਂ ਬਾਅਦ ਆਉਂਦਾ ਹੈ ਟਿੱਕਰ ਪੁਆਇੰਟ ਟਿੱਕਰ ਪੁਆਇੰਟ ਜੋ ਕਿ ਪਹਿਲਾਂ ਵੋਟ ਕਲੱਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਅਤੇ ਇੱਥੇ ਵੋਟ ਕਲੱਬ ਵਿੱਚ ਲੋਕ ਵਾਤਾਵਰਨ ਨੂੰ ਦੇਖਦੇ ਹਨ ਅਤੇ ਵਾਤਾਵਰਨ ਨੂੰ ਦੇਖ ਕੇ ਹੋਰ ਉਤਸ਼ਾਹਿਤ ਹੁੰਦੇ ਹਨ